ਹੈਲੋ ਹਾਂਜੀ ਮਲਕੀਤ ਸਿੰਘ ਜੀ ਕੀ ਹਾਲ ਆ ਵੀਰ ਜੀ ਠੀਕ ਹੈ ਸਪਰੇ ਵਾਲੀ ਦੁਕਾਨ ਤੋਂ ਹੀ ਬੋਲ ਰਹੇ ਹੋ ਆਪਾਂ ਥੋਹਾਥੋ ਬੀਜ ਲੈ ਕੇ ਗਏ ਸੀਗੇ ਜੀ ਨਰਮੇ ਦਾ ਨਾਲੇ ਮੂੰਗੀ ਦਾ ਹਾਂ ਨਰਮਾ ਉਂਝ ਖੜ੍ਹਿਆ ਤਾਂ ਵਧੀਆ ਜੀ ਅਤੇ ਮੱਛਰ ਜਿਹਾ ਮੱਛਰ ਜਿਹਾ ਦਿਖਾਈ ਦਈ ਜਾਂਦਾ ਪੱਤੇ ਜੇ ਇਕੱਠੇ ਕਰੀ ਜਾਂਦਾ ਅੱਛਾ ਅੱਛਾ ਮੈਂ ਕੋਈ ਮੈਂ ਅੱਛਾ ਸਪਰੇ ਹੀ ਆ ਮੈਂਹ ਪਾਣੀ ਪੂਣੀ ਦੇ ਔੜ ਨਾਲ ਤਾਂ ਨਹੀਂ ਕੋਈ ਦਿੱਕਤ ਸਪਰੇ ਕਰਨੀ ਪਊ ਅੱਛਾ ਜੀ ਅੱਛਾ ਅੱਛਾ ਅਤੇ ਇੱਕ ਉਹ ਮੂੰਗੀ ਮੂੰਗੀ ਵਾਸਤੇ ਵੀ ਚਾਹੀਦੇ ਪੱਤੇ ਜੇ ਫਿਰ ਜੀਰੀ ਜੂਰੀ ਲਾਵਾਂਗੇ ਕਿਹੜੀ ਕਰੀਏ

ਅੱਛਾ ਅੱਛਾ ਅੱਛਾ ਉਹ ਪੱਤਿਆਂ ਦੇ ਵਾਸਤੇ ਪੱਤੇ ਡਿੱਗ ਪੈਣਗੇ ਸਾਰੇ ਹਾਂ ਹਾਂ ਬਸ ਐਂ ਵੀ ਬਸ ਸਪਰੇ ਕਰਕੇ ਦੋ ਤਿੰਨ ਦਿਨਾਂ ਬਾਅਦ ਫਿਰ ਵੱਢ ਲਈਏ ਜੀ ਦੋ ਤਿੰਨ ਦਿਨਾਂ 'ਚ ਪੱਤੇ ਝੜ ਜਾਂਦੇ ਹੈ ਅੱਛਾ ਚਾਰ ਦਿਨ ਲੱਗ ਜਾਣਗੇ ਅੱਛਾ ਅੱਛਾ ਅੱਛਾ ਵਧੀਆ ਰਿਜ਼ਲਟ ਵਧੀਆ ਜੀ ਇਹਦਾ ਅੱਛਾ ਅੱਛਾ ਅੱਛਾ ਠੀਕ ਠੀਕ ਹੈ ਠੀਕ ਹੈ ਆਪਣਾ ਇਹ ਦੁਕਾਨ ਹੈ ਕਿੱਥੇ ਜੀ ਡਰੈਸ ਜੀ ਅੱਛਾ ਮੌੜ ਮੰਡੀ ਜੀ ਬੱਸ ਅੱਡੇ ਕੋਲ ਸੀ ਪਹਿਲਾਂ ਤਾਂ ਅਤੇ ਉੱਥੇ ਹੀ ਆ ਜੀ ਠੀਕ ਹੈ ਠੀਕ ਹੈ ਪਹਿਲਾਂ ਵਾਲੀ ਥਾਂ 'ਤੇ ਚੇਂਜ ਨਹੀਂ ਕਰੀ ਤੁਸੀਂ ਠੀਕ ਹੈ ਠੀਕ ਹੈ ਚਲੋ ਆਵਾਂਗੇ ਜੀ ਫਿਰ ਅਸੀਂ ਠੀਕ ਹੈ ਜੀ ਫੋਨ ਮਾਰ ਕੇ ਆ ਜਾਵਾਂਗੇ ਤੁਹਾਨੂੰ ਠੀਕ ਹੈ ਧੰਨਵਾਦ ਜੀ